ਹੁਨਰ ਇੱਕ ਇਨਸਾਨ ਦੀ ਬਹੁਤ ਵੱਡੀ ਪਹਿਚਾਣ ਹੁੰਦੀ ਹੈ ਹੁਨਰ ਆਉਣਾ ਇੱਕ ਇਨਸਾਨ ਦੀ ਕਲਾ ਹੈ ਇਹ ਉਹ ਇਨਸਾਨ ਦੀ ਪਹਿਚਾਣ ਬਣਾਉਂਦਾ ਹੈ ਉਹ ਉਹਨੂੰ ਤਰੱਕੀਆਂ ਵਿੱਚ ਲੈ ਕੇ ਜਾਂਦਾ ਹੈ ਤਕਨੀਕੀ ਹੁਨਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਹੀ ਵੱਡੀ ਇੱਕ ਅਹਿਮੀਅਤ ਬਣ ਚੁੱਕੀ ਹੈ ਅਤੇ ਤਕਨੀਕੀ ਹੁਨਰ ਵਿਗਿਆਨ ਦਾ ਇੱਕ ਕਹਿ ਕਹਿ ਲਉ ਕਰਿਸ਼ਮਾ ਹੈਗਾ ਜਿਹਨੂੰ ਆਉਂਦਾ ਹੈ ਉਹ ਅੱਜ ਤਰੱਕੀਆਂ ਦੀ ਲਹਿ ਵਿੱਚ ਡੁੱਬ ਸਕਦਾ ਹੈ ਮੈਨੂੰ ਤਕਨੀਕੀ ਹੁਨਰ ਬਹੁਤ ਵਧੀਆ ਲੱਗਦੇ ਹਨ ਕੰਪਿਊਟਰ ਤੋਂ ਲੈ ਕੇ ਮੋਬਾਈਲ ਫੋਨ ਅਤੇ ਕੋਡਿੰਗ ਲੈਂਗੁਏਜਿਸ ਸਾਰੀ ਤਕਨੀਕੀ ਮਤਲਬ ਟੈਕਨੀਕਲ ਨੌਲੇਜ ਮੈਨੂੰ ਪਸੰਦ ਹੈ ਸਾਈਬਰ ਸਿਕਿਉਰਿਟੀ ਤੋਂ ਲੈ ਕੇ ਕੋਡਿੰਗ ਤੱਕ ਸਾਰੀਆਂ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਹਨ ਅਤੇ ਪਰ ਜਿਸ ਕੰਪਿ ਪ ਜਿਸ ਤਕਨੀਕੀ ਹੁਨਰ ਦੀ ਮੈਨੂੰ ਜ਼ਿਆਦਾਤਰ ਇੱਛਾ ਵੀ ਹੁੰਦੀ ਹੈ ਲੋੜ ਵੀ ਹੁੰਦੀ ਹੈ ਅਤੇ ਮੈਨੂੰ ਪਸੰਦ ਵੀ ਹੈ ਉਹ ਹ ਉਹ ਹੈਗਾ ਮੇਰਾ ਮੀਡੀਆ ਦਾ ਟ ਤਕਨੀਕੀ ਕੰਮ ਇੱਕ ਤਕਨੀਕੀ ਹੁਨਰ ਜਿਹਨੂੰ ਅਸੀਂ ਡਿਜੀਟਲ ਮਾਰਕੀਟਿੰਗ ਦਾ ਹੁਨਰ ਕਹਿੰਦੇ ਹਾਂ ਉਹ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਉਹਦੀ ਵਰਤੋਂ ਨਾਲ ਕਾਫੀ ਕੁਝ ਅਸੀਂ ਕ੍ਰੀਏਟਿਵਿਟੀ ਕ੍ਰੀਏਟ ਕ੍ਰੀਏਟ ਕਰਦਾ ਹਾਂ ਜਿਹਨੂੰ ਅਸੀਂ ਕੋਂਟੈਂਟ ਕ੍ਰੀਏਸ਼ਨ ਵੀ ਕਹਿੰਦੇ ਹਾਂ ਇਹ ਸਭ ਨਾਲ ਮੈਨੂੰ ਬਹੁਤ ਪਸੰਦ ਹੈ ਪਹਿਲਾਂ ਮੈਂ ਕੋਡਿੰਗ ਵੀ ਸਿੱਖੀ ਹੋਈ ਹੈ ਮੈਨੂੰ ਐਪਸ ਬਣਾਉਣੇ ਵੈਬਸਾਈਟ ਡਿਵੈਲਪਮੈਂਟ ਕਰਨੀਆਂ ਵਧੀਆ ਲੱਗਦੀ ਹੈ ਮੈਨੂੰ ਇਸ ਬਟ ਮੇਰਾ ਸਭ ਤੋਂ ਮਨ ਪਸੰਦੀਦਾ ਤਕਨੀਕੀ ਹੁਨਰ ਹੈਗਾ ਐਡੀਟਿੰਗ ਕਰਨਾ ਕੋਡਿੰਗ ਕਰਨਾ